ਸਤਿ ਸ਼੍ਰੀ ਅਕਾਲ ਸਰ ਮੈਂ ਮਾਨਵ ਪਠਾਣੀਆਂ ਪਠਾਨਕੋਟ ਤੋਂ ਬੋਲ ਰਿਹਾ ਹਾਂ ਕੀ ਤੁਸੀਂ ਸਵੀਗੀ ਤੋਂ ਬੋਲ ਰਹੇ ਹੋ ਸਰ ਜਿਵੇਂ ਕਿ ਤੁਹਾਨੂੰ ਪਤਾ ਹੈ ਕਿ ਸਾਡੇ ਪਠਾਨਕੋਟ ਵਿੱਚ ਇੱਕ ਨਵਾਂ ਰੈਸਟੋਰੈਂਟ ਖੁੱਲ੍ਹਾ ਹੈ ਜਿਸ ਦਾ ਨਾਂ ਵਿਕਟੋਰੀਆ ਕੈਫੇ ਹੈ ਅਤੇ ਉਸ ਰੈਸਟੋਰੈਂਟ ਦੀ ਰੇਟਿੰਗ ਚੈੱਕ ਕਰਨ ਨਾਲ ਮੈਨੂੰ ਇਹ ਪਤਾ ਚਲਿਆ ਕਿ ਉਸ ਰੈਸਟੋਰੈਂਟ ਦੀ ਰੇਟਿੰਗ ਬਹੁਤ ਵਧੀਆ ਹੈ ਜਿਸ ਕਾਰਣ ਮੈਂ ਆਪਣੇ ਅੱਜ ਛੋਟੇ ਬਾਈ ਦੇ ਜਨਮਦਿਨ ਲਈ ਕੁਛ ਵੱਡਾ ਔਡਰ ਪਲੇਸ ਕਰਾਉਣਾ ਚਾਹੁੰਦਾ ਹਾਂ ਜਿਵੇਂ ਕਿ ਆਪ ਜੀ ਨੂੰ ਪਤਾ ਹੈ ਕਿ ਅੱਜ ਮੇਰੇ ਛੋਟੇ ਬਾਈ ਦਾ ਜਨਮਦਿਨ ਹੈ ਉਸ ਲੀਏ ਮੈਂ ਕੁਝ ਔਡਰ ਕਰਾਉਣਾ ਚਾਹੁੰਦਾ ਹਾਂ ਮੇਰਾ ਔਡਰ ਕੁਝ ਇਸ ਸਮਾਨ ਹੈ ਕਿ ਸਰ ਮੈਂ ਸਟਾਰਟਸ ਵਿੱਚ ਤੀਹ ਪੀਸ ਸਪਰਿੰਗ ਰੋਲ ਪਨਤਾਲੀ ਬਰਗਰ ਵੀਹ ਪਲੇਟ ਮੋਮੋ ਮਨਚੂਰੀਅਨ ਅਤੇ ਅੱਠ ਲੀਟਰ ਕੋਲਡਰਿੰਗ ਮੰਗਾਉਣਾ ਚਾਹੁੰਦਾ ਹਾਂ ਅਗਰ ਮੈਂ ਡਿਨਰ ਵੀ ਗੱਲ ਕਰਾਂ ਤਾਂ ਉਸ ਲਈ ਮੈਨੂੰ ਦਾਲ ਮੱਖਣੀ ਪੁਲਾਓ ਪਨੀਰ ਲਬਾਬਦਾਰ ਨਾਨ ਅਤੇ ਗੁਲਾਬ ਜਾਮੁਨ ਦੀ ਮੰਗ ਕਰਦਾ ਹਾਂ ਸਰ ਜਿਵੇਂ ਕਿ ਤੁਹਾਨੂੰ ਪਤਾ ਹੈ ਕਿ ਅੱਜ ਦੇ ਜਨਮਦਿਨ ਦੀ ਪਾਰਟੀ ਲਈ ਮੇਰਾ ਔਡਰ ਕੁਛ ਕਾਫ਼ੀ ਵੱਡਾ ਹੈ ਇਸ ਲਈ ਮੈਂ ਆਪ ਤੋਂ ਛੂਟ ਕੁਪਨ ਦੀ ਮੰਗ ਕਰਦਾ ਹਾਂ ਅਤੇ ਆਸ਼ਾ ਕਰਦਾ ਹਾਂ ਕਿ ਤੁਸੀਂ ਮੈਨੂੰ ਇਹ ਵੱਡੇ ਔਡਰ ਲਈ ਮੈਨੂੰ ਛੂਟ ਕੁਪਨ ਦਿੱਤਾ ਜਾਵੇ ਅਤੇ ਮੈਂ ਆਪ ਜੀ ਨੂੰ ਯਕੀਨ ਦਿਲਾਉਂਦਾ ਹਾਂ ਕਿ ਮੈਂ ਕਾਫ਼ੀ ਬੰਦਿਆਂ ਨੂੰ ਆਪ ਜੀ ਦੇ ਔਡਰ ਰੈਸਟੋਰੈਂਟ ਭੇਜਾਂਗਾ ਧੰਨਵਾਦ